ਜੇਕਰ ਮੈਂ ਆਪਣੇ ਪਿੰਡ ਵਿੱਚ ਕਰਿਆਨੇ ਦੀ ਦੁਕਾਨਾਂ ਦੀ ਗੱਲ ਕਰਾਂ ਤਾਂ ਇਹ ਦੁਕਾਨਾਂ ਇੱਕ ਤਰ੍ਹਾਂ ਦਾ ਜਨਰਲ ਸਟੋਰ ਹੀ ਬਣ ਚੁੱਕੀਆਂ ਹਨ ਇੱਥੇ ਹਰ ਕਿਸਮ ਦਾ ਸਮਾਨ ਸਾਨੂੰ ਬਹੁਤ ਹੀ ਘੱਟ ਸਹੀ ਰੇਟ 'ਤੇ ਮਿਲ ਜਾਂਦਾ ਹੈ ਅਤੇ ਸਾਨੂੰ ਕਦੇ ਵੀ ਪਿੰਡ ਤੋਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਇਹਨਾਂ ਦੁਕਾਨਾਂ 'ਤੇ ਸਾ ਹਰ ਖਾਣ ਪੀਣ ਦੀ ਚੀਜ਼ ਜਿਵੇਂ ਕਿ ਫਾਸਟ ਫੂਡ ਜਾਂ ਹੋਰ ਸ ਘਰ ਦਾ ਸੌਦਾ ਵਗੈਰਾ ਅਤੇ ਬਾਕੀ ਘਰ ਦਾ ਸਮਾਨ ਵੀ ਸਾਨੂੰ ਨੇੜੇ ਤੋਂ ਹੀ ਮਿਲ ਜਾਂਦਾ ਹੈ ਸਾ ਸਾਨੂੰ ਕਦੇ ਵੀ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਹਰ ਕਿਸ ਅਸੀਂ ਅਸੀਂ ਹਮੇਸ਼ਾਂ ਕੈਸ਼ ਦੇ ਕੇ ਹੀ ਸਮਾਨ ਖਰੀਦਦੇ ਹਾਂ ਅਤੇ ਇਹਨਾਂ ਨਾਲ਼ ਕਦੇ ਵੀ ਸੌਦੇਬਾਜ਼ੀ ਨਹੀਂ ਕਰਦੇ ਕਿਉਂਕਿ ਇਹ ਛੋਟੀਆਂ ਦੁਕਾਨਾਂ ਇਹ ਛੋਟੀਆਂ ਦੁਕਾਨਾਂ ਵਾਲੇ ਇਹਨਾਂ ਕੋਲ ਇੰਨਾਂ ਸ ਪੈਸੇ ਨਹੀਂ ਹੁੰਦੇ ਹਨ ਕਿ ਇਹ ਕਿ ਇਹਨਾਂ ਨਾਲ਼ ਬਹੁਤ ਹੀ ਲੰਬਾ ਭੁਗਤਾਨ ਕੀਤਾ ਜਾ ਸਕੇ ਇਸ ਲਈ ਸਾਨੂੰ ਕਦੇ ਵੀ ਇਹਨਾਂ ਦੇ ਪੈਸੇ ਨਹੀਂ ਰੱਖਣੇ ਚਾਹੀਦੇ ਸਾਨੂੰ ਇਹਨਾਂ ਦੇ ਨਾਲ਼ ਹਮੇਸ਼ਾਂ ਹੀ ਭੁਗਤਾਨ ਇਹਨਾਂ ਦਾ ਉਸ ਉਸੇ ਵੇਲੇ ਹੀ ਇਹਨਾਂ ਦੇ ਪੈਸੇ ਦੇਣੇ ਚਾਹੀਦੇ ਹਨ ਅਤੇ ਇਹਨਾਂ ਤੋਂ ਵੱਧ ਤੋਂ ਵੱਧ ਸਮਾਨ ਖਰੀਦਣਾ ਚਾਹੀਦਾ ਹੈ ਤਾਂ ਕਿ ਇਹਨਾਂ ਦਾ ਗੁਜ਼ਾਰਾ ਵੀ ਬਹੁਤ ਵਧੀਆ ਚੱਲੇ